ਹੈਲੋ ਮੈਂ ਉਬਰ ਕੈਬ ਵਾਲੇ ਸਰ ਤੋਂ ਗੱਲ ਕਰ ਰਹੀ ਹਾਂ ਹਾਂਜੀ ਸਰ ਮੈਂ ਇੱਕ ਨਾ ਕੈਬ ਬੁੱਕ ਕੀਤੀ ਸੀ ਤੁਹਾਡੇ ਕੋਲੋਂ ਜੋ ਕਿ ਮੈਨੂੰ ਪਰਸੋਂ ਦੇ ਦਿਨ ਲਈ ਚਾਹੀਦੀ ਸੀ ਪਰ ਕੁਝ ਕਾਰਨਾਂ ਕਰਕੇ ਜ ਮੇਰੀ ਇੱਕ ਐਮਰਜੈਂਸੀ ਮੀਟਿੰਗ ਆ ਗਈ ਹੈ ਜੋ ਕਿ ਮੈਨੂੰ ਮੇਰੇ ਦਫ਼ਤਰ ਵਿੱਚ ਅਟੈਂਡ ਕਰਨੀ ਬਹੁਤ ਜ਼ਰੂਰੀ ਹੈ ਜਿਸ ਦੇ ਕਾਰਨ ਮੈਨੂੰ ਪਰਸੋਂ ਦਾ ਆਪਣਾ ਪ੍ਰੋਗਰਾਮ ਕੈਂਸਲ ਕਰਨਾ ਪਵੇਗਾ ਅਤੇ ਮੈਂ ਜਾ ਨਹੀਂ ਸਕਦੀ ਉਸ ਵੇਲੇ ਇਸ ਕਰਕੇ ਮੇਰਾ ਇਹ ਜਿਹੜਾ ਕੈਬ ਬੁਕਿੰਗ ਹੈ ਉਹ ਕੈਂਸਲ ਕਰ ਦਿੱਤੀ ਜਾਵੇ ਅਤੇ ਜੋ ਮੈਂ ਇੱਕ ਪਹਿਲਾਂ ਹੀ ਭੁ ਆਪਣਾ ਭੁਗਤਾਨ ਕੀਤਾ ਹੋਇਆ ਸੀਗਾ ਜੋ ਪੇ ਪੇਮੈਂਟ ਕੀਤੀ ਹੋਈ ਸੀਗੀ ਕਿਰਪਾ ਕਰਕੇ ਉਹ ਮੇਰੀ ਰਿਫੰਡ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਅਤੇ ਇਹ ਮੈਨੂੰ ਰਿਫੰਡ ਕਦ ਤੱਕ ਵਾਪਸ ਮਿਲ ਸਕਦਾ ਹੈ ਇਸ ਦੇ ਬਾਰੇ ਵੀ ਮੈਨੂੰ ਵੇਰਵਾ ਦੱਸਿਆ ਜਾਵੇ